ਅੱਜ ਦੇ ਸਮੇਂ ਵਿੱਚ ਔਰਤਾਂ ਨੂੰ ਕਾਫੀ ਚੁਣੌਤੀਆਂ ਹਨ ਜਿਨ੍ਹਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਕਿ ਇੱਕ ਵੇਟਰ ਦਾ ਕੰਮ ਢਾਬਾ ਖੋਲ੍ਹਣਾ ਕੰਟੀਨ ਚਲਾਉਣੀ ਅਤੇ ਕਿਸੇ ਡਰਾਇਵਰ ਦਾ ਕੰਮ ਉਹਨਾਂ ਨੂੰ ਥੋੜ੍ਹਾ ਜਿਹਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਹਦੇ ਵਿੱਚ ਕਾਫੀ ਹੱਦ ਤੱਕ ਉਹਨਾਂ ਦੀ ਭੂਮਿਕਾ ਬਦਲ ਜਾਂਦੀ ਹੈ ਸਮਾਜ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਨਹੀਂ ਅਸੈਪਟ ਕਰਨਾ ਚਾਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਕੰਮ ਔਰਤਾਂ ਵਾਸਤੇ ਠੀਕ ਨਹੀਂ ਹਨ ਅਤੇ ਕਈ ਔਰਤਾਂ ਜੋ ਪੜ੍ਹੀਆਂ ਲਿਖੀਆਂ ਨੇ ਉਹ ਆਪਣੇ ਹਿਸਾਬ ਦੇ ਨਾਲ ਕੰਮ ਕਰ ਸਕਦੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਵੇਂ ਆਪਣੀ ਪੜ੍ਹਾਈ ਨੂੰ ਇਹਨਾਂ ਇਹਨਾਂ ਕਾਰੋਬਾਰਾਂ ਦੇ ਵਿੱਚ ਲੈ ਕੇ ਆਉਣਾ ਅਤੇ ਕਿਵੇਂ ਆਪਣੀ ਸੁਰੱਖਿਆ ਆਪ ਕਰਨੀ ਹੈ ਹਾਲੇ ਕਿ ਕਈ ਸਮੇਂ ਤੱਕ ਸੁਰੱਖਿਆ ਨਹੀਂ ਉਹ ਅਪਣੇ ਆਪ ਨੂੰ ਮਹਿਸੂਸ ਕਰ ਪਾਉਂਦੀਆਂ ਲੇਕਿਨ ਪੰਜਾਬ ਸਰਕਾਰ ਦੇ ਹਿਸਾਬ ਦੇ ਨਾਲ ਕਾਫੀ ਫਸਿਲਿਟੀਜ਼ ਨੇ ਪੁਲਿਸ ਦੀ ਸਹਾਇਤਾ ਹੈ ਜਿਹਦੇ ਨਾਲ ਉਹ ਆਪਣੇ ਆਪ ਨੂੰ ਕਾਫੀ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਅਤੇ ਆਪਣਾ ਕਾਰੋਬਾਰ ਅੱਗੇ ਵਧਾ ਸਕਦੀਆਂ ਹਨ ਚੁਣੌਤੀਆਂ ਦਾ ਸਾਹਮਣਾ ਕਰ ਸਕਦੀਆਂ ਹਨ